ਭੰਗੜਾ ਬਹੁਤ ਹੀ ਸ਼ੌਕੀਨ ਚੀਜ਼ ਹੈ ਔਰ ਭੰਗੜਾ ਪੰਜਾਬ ਦੀ ਸ਼ਾਨ ਭੰਗੜਾ ਭੰਗੜਾ ਭੰਗੜਾ ਭੰਗੜੇ ਦੇ ਵਿੱਚ ਜਿਹੜੀ ਲੁੱਡੀ ਪੰਜਾਬ ਔਰ ਇਹਦੇ ਵਿੱਚ ਕਾਫ਼ੀ ਸਟੈਪ ਆ ਜਿਹੜੇ ਉਹ ਪਾਏ ਜਾਂਦੇ ਆ ਔਰ ਇਸਦੇ ਅਧੀਨ ਹੀ ਜਿਹੜਾ ਬੋਲੀਆਂ ਦੇ ਨਾਲ ਭੰਗੜਾ ਜਿਹੜਾ ਹੈ ਬਹੁਤ ਹੀ ਜੱਚਦਾ ਹੈ ਜਿਵੇਂ ਕਿਸੇ ਕਲਾਕਾਰ ਨੇ ਕਿਹਾ ਕਿ ਭੰਗੜੇ ਦੇ ਹੁੰਦੇ ਨੇ ਸ਼ ਸ਼ੌਕੀਨ ਗੱਭਰੂ ਔਰ ਉਹ ਗੱਭਰੂਆਂ ਦੇ ਸਿਰਾਂ 'ਤੇ ਬੱਝੀਆਂ ਹੋਈਆਂ ਪੱਗਾਂ ਤੁਰਲੇਦਾਰ ਔਰ ਛੱਡੇ ਹੋਏ ਜਿਹੜੇ ਖੁੱਲ੍ਹੇ ਚਾਦਰੇ ਅਤੇ ਨਾਲ ਕੱਢਵੀਂ ਜੁੱਤੀਆਂ ਅਤੇ ਉਹਦੇ ਨਾਲ ਜਿਹੜਾ ਕੁੜਤਾ ਹੈ ਉਹ ਹੋਰ ਵੀ ਚਾਰ ਚੰਨ ਲਗਾਉਂਦਾ ਹੈ ਔਰ ਗਲ ਦੇ ਵਿੱਚ ਪਾਇਆ ਕੈਂਠਾ ਜਿਹੜਾ ਪੰਜਾਬ ਦੇ ਭੰਗੜੇ ਨੂੰ ਜਿਹੜਾ ਖੂਬਸੂਰਤ ਬਣਾਉਂਦਾ ਹੈ ਸਾਡੇ ਪੰਜਾਬੀ ਵਿਰਸੇ ਨੂੰ ਬਹੁਤ ਹੀ ਜਿਹੜਾ ਸੋਹਣਾ ਲੱਗਦਾ ਹੈ ਔਰ ਪੂਰਾ ਜਿੱਥੇ ਭੰਗੜਾ ਪੈਂਦਾ ਹੋਵੇ ਉੱਥੇ ਪੂਰਾ ਜਿਹੜਾ ਪੰਡਾਲ 'ਤੇ ਖੁਸ਼ੀਆਂ ਦੇ ਅਲੱਗ ਮਾਹੌਲ ਬਣ ਜਾਂਦੇ ਹੈ ਔਰ ਖੁਸ਼ੀ ਦੇ ਟਾਈਮ ਕਿਸੇ ਜਨਮ ਦਿਨ ਦੇ ਉੱਤੇ ਕਿਸੇ ਵਿਆਹ ਸ਼ਾਦੀ ਦੇ ਉੱਤੇ ਜਾਂ ਸੱਭਿਆਚਾਰ ਮੇਲਿਆਂ ਦੇ ਵਿੱਚ ਜਿਹੜਾ ਹੈ ਭੰਗੜਾ ਜਿਹੜਾ ਪਾਇਆ ਜਾਂਦਾ ਹੈ ਔਰ ਭੰਗੜਾ ਜਿਹੜਾ ਬਹੁਤ ਹੀ ਸੋਹਣੀ ਔਰ ਸੁਚੱਜੀ ਔਰ ਸਿਹਤ ਵਾਸਤੇ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਜਦੋਂ ਭੰਗੜਾ ਪਾਉਂਦਾ ਹੈ ਔਰ ਜੋਸ਼ ਜ਼ੋਰ ਜਿਹੜਾ ਪੱਟਾਂ ਦੇ ਵਿੱਚ ਦਮ ਹੁੰਦਾ ਆ ਔਰ ਉਹ ਭੰਗੜਾ ਜਿਹੜਾ ਹੈ ਪੱਟਾਂ ਦੇ ਜ਼ੋਰ ਨਾਲ ਔਰ ਡੋਲਿਆਂ ਦੇ ਦਮ ਦੇ ਨਾਲ ਪਾਇਆ ਜਾਂਦਾ ਹੈ ਭੰਗੜੇ ਦੇ ਹੁੰਦੇ ਨੇ ਸ਼ੌਕੀਨ ਗੱਭਰੂ ਭੰਗੜੇ ਦੇ ਹੁੰਦੇ ਨੇ ਸ਼ੌਕੀਨ ਗੱਭਰੂ